ਕਿਉਂਕਿ ਮੈਂ ਪੇਂਡੂ ਇਲਾਕੇ ਨਾਲ ਸੰਬੰਧ ਰੱਖਦੀ ਹਾਂ ਇਸ ਕਰਕੇ ਕੋਈ ਇਸ ਤਰ੍ਹਾਂ ਖ਼ਾਸ ਵਿਅਕਤੀ ਜਾਂ ਗਰੁੱਪ ਨਹੀਂ ਹੈਗਾ ਜਿਸ ਨੇ ਸਾਡੇ ਕਹਿ ਲਓ ਵੀ ਡਾਂਸ ਪ੍ਰਦਰਸ਼ਨਾਂ ਦੇ ਵਿੱਚ ਉਹਨਾਂ ਨੂੰ ਸੁਧਾਰਿਆ ਹੋਵੇ ਪਰ ਫਿਰ ਵੀ ਸਾਡੇ ਜਿਹੜੇ ਸਕੂਲਸ ਦੇ ਵਿੱਚ ਅਸੀਂ ਪੜ੍ਹੇ ਹੋਏ ਹਾਂ ਉੱਥੇ ਪਰਟੀ ਮਤਲਬ ਇਸ ਤਰ੍ਹਾਂ ਫੰਕਸ਼ਨ ਜਿਹੜੇ ਸੀਗੇ ਉਹ ਟਾਈਮ ਟਾਈਮ 'ਤੇ ਕਰਵਾਏ ਜਾਂਦੇ ਸੀ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਪਾਰਟੀਸਪੇਟ ਕਰਨ ਲਈ ਕਿਹਾ ਜਾਂਦਾ ਸੀਗਾ ਫਿਰ ਸਾਡੇ ਟੀਚਰਸ ਜਿਹੜੇ ਸੀਗੇ ਉਹ ਸਾਨੂੰ ਮਤਲਬ ਬਿਨਾਂ ਕਿਸੇ ਝਿੜਕ ਤੋਂ ਜਿੱਥੇ ਅਸੀਂ ਗਲਤੀ ਕਰਦੇ ਸੀ ਉੱਥੇ ਸੁਧਾਰਦੇ ਸੀਗੇ ਸਾਨੂੰ ਅਤੇ ਇਸੇ ਤਰੀਕੇ ਦੇ ਨਾਲ ਹੀ ਸਾਡੇ ਅੰਦਰ ਕਹਿ ਲਓ ਕਿ ਮੇਰੇ ਅੰਦਰ ਡਾਂਸ ਦੀ ਜਿਹੜੀ ਰੁਚੀ ਸੀ ਉਹ ਪੈਦਾ ਹੋਈ ਹੋਰਾਂ ਲੋਕਾਂ ਨੂੰ ਡਾਂਸ ਕਰਨ ਲਈ ਮੈਂ ਉਤਸ਼ਾਹਿਤ ਇਸ ਤਰ੍ਹਾਂ ਕਰਦੀ ਹਾਂ ਕਿ ਜਿਵੇਂ ਕਈ ਤਾਂ ਹੁੰਦੇ ਆ ਜਿਹਨਾਂ ਨੂੰ ਸ਼ੁਰੂ ਤੋਂ ਹੀ ਡਾਂਸ ਕਰਨਾ ਆਉਂਦਾ ਹੁੰਦਾ ਹੈ ਪਰ ਅਗਰ ਕਿਸੇ ਨੂੰ ਨਹੀਂ ਵੀ ਆਉਂਦਾ ਤਾਂ ਮੈਂ ਬਸ ਉਹਨਾਂ ਨੂੰ ਇਹੀ ਕਹਿੰਦੀ ਹਾਂ ਕਿ ਕਿਸੇ ਦੇ ਵੀ ਕਿਸੇ ਦੇ ਵੀ ਡਰ ਦੇ ਨਾਲ ਜਾਂ ਕੋਈ ਮੈਨੂੰ ਦੇਖ ਕੇ ਕੀ ਕਹੂਗਾ ਜਾਂ ਮੇਰੇ ਡਾਂਸ ਨੂੰ ਕਿ ਕਿਸੇ ਨੂੰ ਪਸੰਦ ਆਉਣਾ ਹੈ ਕਿ ਨਹੀਂ ਆਉਣਾ ਇਹਨਾਂ ਸਭ ਚੀਜ਼ਾਂ ਬਾਰੇ ਸੋਚਣ ਦਾ ਕੋਈ ਫਾਇਦਾ ਨਹੀਂ ਹੈਗਾ ਤੁਹਾਨੂੰ ਜਿਵੇਂ ਚੰਗਾ ਲੱਗਦਾ ਹੈ ਆਪਾਂ ਉਵੇਂ ਹੀ ਡਾਂਸ ਕਰਨਾ ਹੈ ਬਿਨਾਂ ਕਿਸੇ ਦੀ ਝਿਜਕ ਤੋਂ ਬਿਨਾਂ ਕਿਸੇ ਦੇ ਡਰ ਨੂੰ ਮਨ ਦੇ ਵਿੱਚ ਰੱਖਿਆ ਜਦੋਂ ਆਪਾਂ ਡਾਂਸ ਕਰਦੇ ਹਾਂ ਤਾਂ ਉਹ ਆਪਣੇ ਆਪ ਹੀ ਵਧੀਆ ਹੋ ਜਾਂਦਾ ਹੈ ਸੋ ਡਾਂਸ ਆਪਾਂ ਕਿਸੇ ਦੀ ਖੁਸ਼ੀ ਲਈ ਨਹੀਂ ਕਰਨਾ ਆਪਣੀ ਖੁਸ਼ੀ ਲਈ ਕਰਨਾ